ਹਾਂਜੀ ਪੰਜਾਬੀ ਸੱਭਿਆਚਾਰ ਵਿੱਚ ਜਿਵੇਂ ਭੰਗੜੇ ਦੀ ਮਹੱਤਤਾ ਬਾਰੇ ਪੁੱਛਿਆ ਗਿਆ ਹੈ ਤਾਂ ਭੰਗੜੇ ਦੀ ਤਾਂ ਬਹੁਤ ਮਹੱਤਤਾ ਹੈ ਜਿਵੇਂ ਆਪਾਂ ਕੋਈ ਵੀ ਤਿਉਹਾਰ ਹੈ ਕੋਈ ਵੀ ਪ੍ਰੋਗਰਾਮ ਹੈ ਖੁਸ਼ੀ ਦਾ ਤਾਂ ਉਹ ਭੰਗੜੇ ਨਾਲ ਹੀ ਸ਼ੁਰੂਆਤ ਹੁੰਦੀ ਹੈ ਜਿਸ ਤਰ੍ਹਾਂ ਢੋਲ ਵਗੈਰਾ ਜਦੋਂ ਕਿਤੇ ਫੰਕਸ਼ਨ 'ਚ ਕਿਤੇ ਵੀ ਵੱਜਦਾ ਆਸ ਪਾਸ ਆਸ ਪੜੋਸ ਕਿਤੇ ਵੀ ਤਾਂ ਆਪਾਂ ਘਰੇ ਘਰੇ ਖੜੇ ਹੀ ਉਹਦੇ ਨਾਲ ਭੰਗੜਾ ਪਾਉਣ ਲੱਗ ਪੈਂਦੇ ਹਾਂ ਤਾਂ ਇਸ ਕਰਕੇ ਭੰਗੜੇ ਦੇ ਤਾਂ ਆਪਣੇ ਕੋਈ ਵੀ ਫੰਕਸ਼ਨ ਹੈ ਭੰਗੜੇ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦਾ ਜਿਵੇਂ ਜਾਗੋ ਵਗੈਰਾ ਆ ਸਭ ਤੋਂ ਜ਼ਿਆਦਾ ਭੰਗੜੇ ਦਾ ਹੀ ਹੁੰਦਾ ਉਹਦੇ ਵਿੱਚ ਕਰੇਜ਼ ਤਾਂ ਬਾਕੀ ਹੋਰ ਵੀ ਜਿਹੜੇ ਕੋਈ ਆਪਾਂ ਕੋਈ ਵੀ ਤਿਉਹਾਰ ਕੋਈ ਵੀ ਖੁਸ਼ੀ ਕੋਈ ਬੱਚਾ ਆਪਣੇ ਜਨਮ ਲੈਂਦਾ ਜਾਂ ਕੁਛ ਵੀ ਹੈ ਤਾਂ ਉਹਦੀ ਸ਼ੁਰੂਆਤ ਭੰਗੜੇ ਨਾਲ ਹੀ ਹੁੰਦੀ ਹੈ ਜਿਵੇਂ ਲੁੱਡੀ ਵਗੈਰਾ ਤਾਂ ਜਿਵੇਂ ਹੋਰ ਵੀ ਕਈ ਭੰਗੜੇ ਦੇ ਪਾਰਟ ਹੁੰਦੇ ਆ ਤਾਂ ਇਸ ਕਰਕੇ ਵੀ ਬਾਕੀ ਪੰਜਾਬ ਦੇ ਤਿਉਹਾਰਾਂ ਵਿੱਚ ਇਹਦਾ ਹਿੱਸਾ ਇਸੇ ਕਰਕੇ ਬਣਿਆ ਕਿਉਂਕਿ ਇਹਦੇ ਤੋਂ ਬਿਨਾਂ ਕੋਈ ਤਿਉਹਾਰ ਸ਼ੁਰੂਆਤ ਹੀ ਨਹੀਂ ਹੁੰਦੀ ਗੀ ਅਤੇ ਸਭ ਤੋਂ ਜ਼ਿਆਦਾ ਵਿ ਵਿਸਾਖੀ ਦੇ ਵਿੱਚ ਵੀ ਜਿਵੇਂ ਵਿਸ ਵਿਸਾਖੀ ਦਾ ਮੇਲਾ ਹੁੰਦਾ ਉਦੋਂ ਭੰਗੜੇ ਦਾ ਜ਼ਿਆਦਾ ਉਹ ਹੁੰਦਾ ਅਤੇ ਬਾਕੀ ਜਿਵੇਂ ਸਕੂਲਾਂ ਕਾਲਜਾਂ ਵਿੱਚ ਭੰਗੜਾ ਗਿੱਧਾ ਇਹ ਚੀਜ਼ਾਂ ਦਾ ਹੀ ਜ਼ਿਆਦਾ ਹੁੰਦਾ ਵੀ ਇਹ ਹਮੇਸ਼ਾ ਇਹ ਪਾਰਟ ਜ਼ਰੂਰ ਹੁੰਦਾ ਜੇ ਕੋਈ ਕਾਲਜ ਵਗੈਰਾ 'ਚ ਫੰਕਸ਼ਨ ਹੁੰਦੇ ਆ ਜਾਂ ਬੱਚਿਆਂ ਦੇ ਤਾਂ ਭੰਗੜਾ ਬੋਆਇਜ ਲਈ ਭੰਗੜਾ ਹੁੰਦਾ ਅਤੇ ਲੇਡੀਜ ਵਗੈਰਾ ਜਿਵੇਂ ਗਿੱਧਾ ਦਾ ਵਿਆਹਵਾਂ 'ਚ ਜਦੋਂ ਆਪਾਂ ਵਿਆਹ ਸ਼ਾਦੀ ਕਰਦੇ ਹਾਂ ਤਾਂ ਆਪਾਂ ਤਿੰਨ ਤਿੰਨ ਚਾਰ ਚਾਰ ਦਿਨ ਜਦੋਂ ਢੋਲੀ ਨੂੰ ਬੁਲਾਉਦੇ ਹਾਂ ਤਾਂ ਭੰਗੜਾ ਹੀ ਪੈਂਦਾ ਰਹਿੰਦਾ ਘਰਾਂ 'ਚ ਆਪਾਂ ਆਸੇ ਪਾਸੇ ਜਿੱਧਰ ਵੀ ਫਿਰਦੇ ਹਾਂ ਆਪਾਂ ਖੁਸ਼ੀ ਦੇ ਵਿੱਚ ਭੰਗੜਾ ਹੀ ਪਾਉਂਦੇ ਫਿਰਦੇ ਹਾਂ ਭੰਗੜੇ ਤੋਂ ਬਿਨਾਂ ਕੋਈ ਆਪਾਂ ਨੂੰ ਲੱਗਦਾ ਹੀ ਨਹੀਂ ਵੀ ਹਾਂ ਇਹ ਕੋਈ ਵਿਆਹ ਹੋ ਰਿਹਾ ਜੇ ਕਿਸੇ ਦੇ ਕੋਈ ਢੋਲ ਵਗੈਰਾ ਨਾ ਆਵੇ ਕੋਈ ਭੰਗੜਾ ਨਾ ਪਵੇ ਤਾਂ ਆਪਾਂ ਕਹਿ ਦਿੰਦੇ ਹਾਂ ਲੈ ਇਹ ਬੜਾ ਵਿਆਹ ਹੋਇਆ ਕੋਈ ਰੌਣਕ ਨਹੀਂ ਭੰਗੜੇ 'ਚ ਇਸ ਕਰਕੇ ਭੰਗੜੇ ਦੀ ਸਾਰਿਆਂ ਨਾਲੋਂ ਜ਼ਿਆਦਾ ਅਹਿਮੀਅਤ ਹੈ ਵੀ ਭੰਗੜੇ ਤੋਂ ਬਿਨਾਂ ਆਪਣੇ ਕੋਈ ਵਿਆਹ ਕੰਪਲੀਟ ਹੁੰਦਾ ਹੀ ਨਹੀਂ ਤਾਂ ਬਾਕੀ ਭੰਗੜਾ ਜਿਹੜਾ ਆਪਣਾ ਇਤਿਹਾਸਿਕ ਹੈ ਵੀ ਇਹ ਸ਼ੁਰੂਆਤ ਤੋਂ ਹੀ ਚੱਲਿਆ ਆ ਰਿਹਾ ਤਾਂ ਹੁਣ ਵੀ ਹੁਣ ਤਾਂ ਬਹੁਤ ਜ਼ਿਆਦਾ ਕਰੇਜ਼ ਹੈ ਬੱਚੇ ਛੋਟੇ ਛੋਟੇ ਬੱਚੇ ਸਕੂਲਾਂ 'ਚ ਫੰਕਸ਼ਨ ਹੁੰਦਾ ਉਦੋਂ ਭੰਗੜੇ 'ਚ ਛੋਟੇ ਛੋਟੇ ਬਹੁਤ ਸੋਹਣੇ ਲੱਗਦੇ ਆ ਜਦੋਂ ਪੰਜਾਬੀ ਪਹਿਰਾਵਾ ਪਾਇਆ ਹੁੰਦਾ ਬੱਚਿਆਂ ਨੇ ਸੋਹਣਾ ਉਸ ਲੁੱਕ 'ਚ ਤਿਆਰ ਹੋਏ ਹੁੰਦੇ ਹਨ ਸਾਰਾ ਜਿਵੇਂ ਕੈਂਠਾ ਟੋਰੇ ਵਾਲੀ ਪੱਗ ਚਾਦਰਾ ਕੁੜਤਾ ਛੋਟੇ ਛੋਟੇ ਬੱਚੇ ਬਹੁਤ ਪਿਆਰੇ ਲੱਗ ਰਹੇ ਹੁੰਦੇ ਹਨ ਵੀ ਉਹ ਵੀ ਬੜੀ ਖੁਸ਼ੀ ਖੁਸ਼ੀ ਭੰਗੜੇ ਨੂੰ ਬੜੀ ਖੁਸ਼ੀ ਖੁਸ਼ੀ ਕਰਦੇ ਆ ਅਤੇ ਬੜੀ ਖੁਸ਼ੀ ਖੁਸ਼ੀ ਉਹਦੇ 'ਚ ਪਾਰਟੀਸਪੇਟ ਕਰਦੇ ਆ ਕਿਉਂਕਿ ਉਹਨਾਂ ਨੂੰ ਵੀ ਐਂ ਹੁੰਦਾ ਵੀ ਇਹ ਭੰਗੜਾ ਸਾਡਾ ਪੰਜਾਬੀ ਵਿਰਸਾ ਹੈ ਸੋ ਇਸ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਸਭ ਤੋਂ ਜ਼ਿਆਦਾ ਤਾਂ ਭੰਗੜੇ ਅਤੇ ਲੇਡੀਜ਼ ਵਿੱਚ ਗਿੱਧੇ ਦੀ ਅਹਿਮੀਅਤ ਹੈ ਇਹ ਆਪਣੇ ਸਮਾਜ ਦਾ ਸਾਰਿਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹਿੱਸਾ